ਅੱਜ ਮੈਂ ਫਿਲਮ ਦੇਖਣਾ ਚਾਹੁੰਦੀ ਸਾਂ ਫਿਲਮ ਦੇਖਣ ਦੇ ਪੂਰੇ ਮੂੜ ਵਿੱਚ ਸਾਂ ਅਤੇ ਮੈਨੂੰ ਇਹ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਕਿਸ ਤਰ੍ਹਾਂ ਦੀ ਮੂਵੀ ਦੇਖਾਂ ਮੈਨੂੰ ਮੂਵੀ ਦੇਖਣਾ ਬਹੁਤ ਪਸੰਦ ਹੈ ਅੱਜ ਮੈਂ ਪੰਜਾਬੀ ਮੂਵੀ ਦੇਖਾਂ ਜਾਂ ਫਿਰ ਕੋਈ ਹਿੰਦੀ ਮੂਵੀ ਪੰਜਾਬੀ ਮੂਵੀ ਮੈਨੂੰ ਪੁਰਾਣੇ ਸਮੇਂ ਦੀਆਂ ਪਸੰਦ ਹਨ ਪੰਜਾਬੀ ਮੂਵੀ ਸਾਨੂੰ ਬਹੁਤ ਕੁਝ ਦਰਸਾਉਂਦੀਆਂ ਹਨ ਅੱਜ ਮੈਂ ਇਹ ਫੈਸਲਾ ਕਰਨ ਵਿੱਚ ਮਦਦ ਲੈਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਥੋੜ੍ਹੀ ਜਿਹੀ ਮਦਦ ਕਰੋ ਕਿ ਮੈਂ ਕਿਸ ਤਰ੍ਹਾਂ ਦੀ ਮੂਵੀ ਦੇਖਾਂ ਅੱਤੇ ਆਪਣਾ ਇੱਕ ਚੰਗਾ ਸਮਾਂ ਬਤੀਤ ਕਰਾਂ ਅਤੇ ਆਰਾਮਦਾਇਕ ਫਿਲਮ ਦੇਖਾਂ